ਰੋਪੜ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਥਾਨਕ ਰਿਹਾਇਸ਼ੀ ਵਿਕਲਪ ਹਨ ਜੋ ਕਿ ਦੋ ਜਿਨ੍ਹਾਂ ਵਿੱਚ ਦੋ ਕਮਰੇ ਅਤੇ ਇੱਕ ਬਾਥਰੂਮ ਸਿਰਫ ਦੋ ਹਜ਼ਾਰ ਰੁਪਏ ਵਿੱਚ ਮਿਲ ਜਾਂਦਾ ਹੈ ਜੇ ਕੋਈ ਰੋਪੜ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਛੋਟਾ ਘਰ ਵੀ ਮਿਲ ਜਾਊਗਾ ਕਿਰਾਏ 'ਤੇ ਅਤੇ ਬੜਾ ਘਰ ਵੀ ਜੇ ਤੁਸੀਂ ਰੋਪੜ ਰੂਪਨਗਰ ਜ਼ਿਲ੍ਹੇ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਹੋ ਸ਼ਿਕਸ਼ਾ ਲਈ ਆਏ ਹੋ ਤਾਂ ਇੱਥੇ ਬਹੁਤ ਸਾਰੇ ਸੈਂਟਰ ਖੁੱਲ੍ਹੇ ਹਨ ਜਿੱਥੇ ਤੁਸੀਂ ਕੰਮ ਵੀ ਕਰ ਸਕਦੇ ਹੋ ਆਈਲੈਟਸ ਵੀ ਸਿੱਖ ਸਕਦੇ ਹੋ ਸਿੱਖ ਸਕਦੇ ਹੋ ਅਤੇ ਨਿਊ ਮਾਰਕਿਟ ਵੀ ਖੁੱਲ੍ਹੀ ਹੈ ਜਿੱਥੇ ਤੁਸੀਂ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਇੱਥੇ ਦੁਕਾਨਾਂ ਕਿਰਾਏ 'ਤੇ ਵੀ ਮਿਲ ਜਾਂਦੀਆਂ ਹਨ